ਭਾਰਤ ਭਿੰਨਤਾਵਾਂ ਭਰਿਆ ਦੇਸ਼ ਹੈ ਅਤੇ ਇੱਥੇ ਕਈ ਮੌਸਮ ਬਦਲਦੇ ਰਹਿੰਦੇ ਹਨ ਜਿਵੇਂ ਭਾਰਤ ਵਿੱਚ ਕਿਸੇ ਵੇਲੇ ਸਰਦੀ ਹੋ ਗਈ ਗਰਮੀ ਹੋ ਗਈ ਪੱਤਝੜ ਹੋ ਗਈ ਇਸ ਕਰਕੇ ਭਾਰਤ ਦੇ ਵਿੱਚ ਹਰ ਖੇਤਰ ਦੇ ਵਿੱਚ ਅਲੱਗ ਅਲੱਗ ਮੌਸਮ ਹੁੰਦਾ ਹੈ ਜਿੱਦਾਂ ਕਿ ਪੰਜਾਬ ਦੇ ਵਿੱਚ ਸਰਦੀ ਪੈਂਦੀ ਹੈ ਅਤੇ ਕਿਉਂਕਿ ਪੰਜਾਬ ਦੇ ਅੱਗੇ ਹਿਮਾਚਲ ਆ ਹਿਮਾਚਲ ਦੇ ਗਲੇਸ਼ੀਅਰ ਜਦੋਂ ਪਿਗਲਦੇ ਆ ਅਤੇ ਇੱਥੇ ਠੰਡ ਪੈ ਜਾਂਦੀ ਹੈ ਅਤੇ ਜਿਹੜੇ ਮੁੰਬਈ ਵਗੈਰਾ ਦੇ ਸ਼ਹਿਰ ਹੈਗੇ ਹੈ ਉਹ ਕਿਉਂਕਿ ਸਮੁੰਦਰ ਦੇ ਕੋਲ ਹੈ ਇਸ ਕਰਕੇ ਉੱਥੇ ਗਰਮੀ ਪੈਂਦੀ ਹੈ ਜਿਵੇਂ ਕਿ ਗੁਜਰਾਤ ਲੈ ਲਓ ਗੁਜਰਾਤ ਵਿੱਚ ਵੀ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਕਿਉਂਕਿ ਕਿਉਂ ਭੂ ਮੱਧ ਰੇਖਾ ਭਾਰਤ ਦੇ ਵਿੱਚ ਕਰੋ ਭੂ ਮੱਧ ਰੇਖਾ ਦੀ ਗੁਜਰਦੀ ਹੈ ਇਸ ਕਰਕੇ ਇਸ ਰੇਖਾ ਕਰਕੇ ਹੀ ਉੱਥੇ ਜਿਹੜੇ ਉਹਨਾਂ ਭੁ ਮੱਧ ਰੇਖਾ ਦੇ ਕੋਲ ਦੇ ਇਲਾਕੇ ਹੈਗੇ ਆ ਉਹਦਾ ਦੇ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਪੈਂਦੀ ਹੈ ਪੰਜਾਬ ਦੇ ਵਿੱਚ ਸਰਦੀ ਹੁੰਦੀ ਹੈ ਪੰਜਾਬ ਦੇ ਵਿੱਚ ਵੀ ਕਈ ਮੌਸਮ ਜਿੱਦਾਂ ਬਦਲਦੇ ਰਹਿੰਦੇ ਆ ਜਿੱਦਾਂ ਗਰਮੀ ਆ ਗਈ ਆ ਸਰਦੀ ਆ ਗਈ ਆ ਪੱਤਝੜ ਆ ਗਈ ਆ ਅਤੇ ਸਰਦੀ ਕਿਉਂ ਹੁੰਦੀ ਹੈ ਇਹਦੇ ਵਿੱਚ ਕਿਉਂਕਿ ਪੰਜਾਬ ਦੇ ਨਾਲ ਹਿਮਾਚਲ ਲੱਗਦਾ ਜੰਮੂ ਕਸ਼ਮੀਰ ਲੱਗਦਾ ਅਤੇ ਉੱਥੇ ਬਰਫ਼ ਪੈਂਦੀ ਆ ਤਾਂ ਜਿਹਦੇ ਕਰਕੇ ਠੰਡੀ ਹਵਾ ਸਾਡੇ ਪੰਜਾਬ ਦੇ ਵਿੱਚ ਆਉਂਦੀ ਉਸ ਠੰਡੀਆਂ ਹਵਾਵਾਂ ਦੇ ਕਾਰਨ ਹੀ ਸਾਡੇ ਪੰਜਾਬ ਦਾ ਜਿਹੜਾ ਹੈ ਵਾਤਾਵਰਨ ਬਦਲ ਜਾਂਦਾ ਅਤੇ ਜਿਹੜਾ ਕਿ ਸਰਦੀ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਉਹ ਜਦੋਂ ਇੱਥੇ ਗਰਮੀ ਪੈਂਦੀ ਹੈ ਤਾਂ ਬਾਕੀ ਸਮੁੰਦਰ ਦੇ ਕੰਢੇ 'ਤੇ ਜਿਹੜੇ ਸ਼ਹਿਰ ਹੈ ਉੱਥੇ ਠੀਕ ਠੀਕ ਮੌਸਮ ਹੀ ਹੁੰਦਾ ਹੈ ਜਿਵੇਂ ਕਿ ਲਗਾ ਲਓ ਤੁਸੀਂ ਮਹਾਰਾਸ਼ਟਰ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਕਰਨਾਟਕਾ ਹੋ ਗਿਆ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਇੰਨੀ ਜ਼ਿਆਦਾ ਸਰਦੀ ਨਹੀਂ ਪੈਂਦੀ ਹੈ ਉਹਨਾਂ ਦੇ ਵਿੱਚ ਸਿਰਫ਼ ਗਰਮੀ ਹੀ ਰਹਿੰਦੀ ਹੈ ਤਾਪਮਾਨ ਬਿਲਕੁਲ ਸਹੀ ਹੀ ਰਹਿੰਦਾ ਹੈ ਗਰਮੀ ਅਤੇ ਸਰਦੀ ਅਲੱਗ ਅਲੱਗ ਜਿਹੜੇ ਮੌਸਮ ਆ ਉਹ ਭਾਰਤ ਵਿੱਚ ਬਦਲਦੇ ਰਹਿੰਦੇ ਉਹਨਾਂ ਦਾ ਖੇਤਰ ਦਾ ਹਰ ਤਰੀਕਾ ਅਲੱਗ ਅਲੱਗ ਹੁੰਦਾ ਹੈ ਜਿਵੇਂ ਕਿ ਜਿਹਤੇ ਕਈ ਪ੍ਰਦੇਸ਼ਾਂ ਦੇ ਵਿੱਚ ਗਰਮੀ ਜ਼ਿਆਦਾ ਪੈ ਗਈ ਹੈ ਕਿਸੇ ਕਈਆਂ ਦੇ ਵਿੱਚ ਸਰਦੀ ਜ਼ਿਆਦਾ ਪੈ ਗਈ ਹਿਮਾਚਲ ਦੇ ਕਾਫ਼ੀ ਠੰਡਾ ਆ ਸਾਡਾ ਇਲਾਕਾ ਕਿਉਂਕਿ ਉੱਥੇ ਅੱਗੇ ਪਹਾੜ ਆ ਪਹਾੜਾਂ ਦੇ ਕਰਕੇ ਜ਼ਿਆਦਾ ਹੋ ਜਾਂਦਾ ਹੈ